ਸਤਿ ਸ਼੍ਰੀ ਅਕਾਲ ਜੀ ਜਾਨਵਰਾਂ ਦੀ ਦੇਖਭਾਲ ਲਈ ਕੁਦਰਤੀ ਅਤੇ ਜੈਵਿਕ ਢੰਗਾਂ ਦੀ ਵਰਤੋਂ ਕਰਨ ਦੇ ਕੁਝ ਲਾਭ ਇਹ ਹਨ ਕਿ ਜੋ ਜਾਨਵਰ ਹਨ ਤਾਂ ਇਹਨਾਂ ਦੀ ਦੇਖਭਾਲ ਕੁਦਰਤੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਜੋ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਜਿਹਨਾਂ ਦੇ ਵੀ ਮੱਝਾਂ ਅਤੇ ਗਾਵਾਂ ਜਾਂ ਪਸ਼ੂ ਰੱਖੇ ਹੋਏ ਹਨ ਉਹ ਆਪਣਾ ਹਰਾ ਚਾਰਾ ਆਪ ਤਿਆਰ ਕਰਕੇ ਅਤੇ ਹਰੇ ਚਾਰੇ ਦਾ ਅੱਜ ਕੱਲ੍ਹ ਇੱਕ ਨਵਾਂ ਟਰੈਂਡ ਪਿੰਡਾਂ ਦੇ ਵਿੱਚ ਚੱਲਿਆ ਹੋਇਆ ਹੈ ਕਿ ਜੋ ਬਾਜਰਾ ਹੁੰਦਾ ਹੈ ਬਾਜਰੇ ਨੂੰ ਕੱਟ ਕੇ ਇੱਕ ਟੋਆ ਪੁੱਟ ਕੇ ਉਸਦੇ ਵਿੱਚ ਦੱਬਿਆ ਜਾਂਦਾ ਹੈ ਉਸ ਦੇ ਵਿੱਚ ਨਮਕ ਵਗੈਰਾ ਪਾ ਕੇ ਜਿਸ ਤਰ੍ਹਾਂ ਉਸਨੂੰ ਪਿੰਡਾਂ ਦੇ ਵਿੱਚ ਅਚਾਰ ਕਿਹਾ ਜਾਂਦਾ ਹੈ ਅਤੇ ਹੁਣ ਆਲੇ ਦੁਆਲੇ ਪਿੰਡਾਂ ਦੇ ਲਾਗੇ ਕਿਸਾਨਾਂ ਨੂੰ ਫੈਕਟਰੀਆਂ ਵੀ ਲੱਗ ਚੁੱਕੀਆਂ ਹਨ ਜ਼ਿਆਦਾਤਰ ਉਹ ਆਚਾਰ ਦੇ ਰੂਪ ਦੇ ਵਿੱਚ ਬਾਜਰਾ ਮ ਪਸ਼ੂਆਂ ਨੂੰ ਮਿਲਣ ਲੱਗਿਆ ਹੈ ਪਰ ਉਹ ਸਿਹਤ ਅਤੇ ਬੱਚੇਦਾਨੀ ਲਈ ਹਾਨੀਕਾਰਕ ਚੀਜ਼ ਹੈ ਪਸ਼ੂਆਂ ਨੂੰ ਸਿਰਫ ਇੱਕ ਹਰਾ ਚਾਰਾ ਜੋ ਕੁਦਰਤੀ ਤਰੀਕੇ ਦੇ ਨਾਲ ਮੌਸਮੀ ਹੁੰਦਾ ਹੈ ਜਿੱਦਾਂ ਬਰਸੀਨ ਅਤੇ ਬਾਜਰਾ ਹੁੰਦਾ ਹੈ ਇਹੀ ਪਾਉਣਾ ਚਾਹੀਦਾ ਹੈ ਜੋ ਜੈਵਿਕ ਢੰਗ ਦੀ ਵਰਤੋਂ ਹੈ ਉਹ ਘੱਟ ਕਰਨੀ ਚਾਹੀਦੀ ਹੈ ਅਤੇ ਆਪਣੇ ਕਿਸੇ ਤਰ੍ਹਾਂ ਕੋਈ ਬੜੇਮੇ ਮਿਲ ਜਾਣ ਜਾਂ ਕੋਈ ਆਪਣਾ ਸਰ੍ਹੋਂ ਦੀ ਖਲ ਇਹ ਪਸ਼ੂਆਂ ਨੂੰ ਪਾਈ ਜਾਵੇ ਤਾਂ ਇਸਦਾ ਫਾਇਦਾ ਹੁੰਦਾ ਹੈ ਜੋ ਫੀਡਾਂ ਕ ਕੋਂਪਣੀਆਂ ਵੱਲੋਂ ਆਉਂਦੀਆਂ ਹਨ ਉਸਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਪ੍ਰੋਟੀਨ ਹੁੰਦਾ ਹੈ ਅੱਗੇ ਤੁਸੀਂ ਪੁੱਛਿਆ ਹੈ ਕੀ ਤੁਹਾਨੂੰ ਘਰ ਵਿੱਚ ਆਪਣੇ ਬਜ਼ੁਰਗਾਂ ਤੋਂ ਕੋਈ ਰਵਾਇਤੀ ਸਲਾਹ ਮਿਲੀ ਹੈ ਜੀ ਹਾਂ ਸਾਨੂੰ ਸਾਡੇ ਬਜ਼ੁਰਗਾਂ ਤੋਂ ਹੀ ਅੱਗੇ ਜੋ ਨਵੇਂ ਪੀੜ੍ਹੀ ਦੇ ਕਿਸਾਨ ਹਾਂ ਜਾਂ ਅਸੀਂ ਦਰਮਿਆਨੀ ਪੀੜ੍ਹੀ ਦੇ ਮੇਰੀ ਉਮਰ ਚੁਤਾਲੀ ਸਾਲ ਹੈ ਮੈਂ ਆਪਣੇ ਬਜ਼ੁਰਗਾਂ ਤੋਂ ਬਹੁਤ ਕੁਛ ਸਿੱਖਿਆ ਹੈ ਸਾਡੇ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਹੈ ਕਿ ਕਿਹੜੀ ਕਿਹੜੀ ਕਿਸਮ ਦੇ ਪਸ਼ੂ ਹਨ ਜੋ ਦੁੱਧ ਲਈ ਵਧੀਆ ਹੁੰਦੇ ਹਨ ਜਿੱਦਾਂ ਸਾਹੀਵਾਲ ਨਸਲ ਹੈ ਜਾਂ ਇਹ ਨਸਲਾਂ ਬ ਰੱਖਣੀਆਂ ਚਾਹੀਦੀਆਂ ਹਨ ਅਤੇ ਜੋ ਦੇਸੀ ਗਾਵਾਂ ਨੇ ਉਹ ਦੁੱਧ ਲਈ ਵਧੀਆ ਹੁੰਦੀਆਂ ਹਨ ਅਤੇ ਹੋਰ ਗਾਵਾਂ ਨੇ ਕਈ ਗਾਵਾਂ ਦੇ ਵਿੱਚ ਜਿੱਦਾਂ ਐੱਚ ਐੱਫ ਹੈ ਉਹ ਗਾਵਾਂ ਸਾਡੇ ਬਜ਼ੁਰਗ ਕਾਫੀ ਰੱਖਣ ਤੋਂ ਰੋਕਦੇ ਵੀ ਹਨ ਕੁੱਲ ਮਿਲਾ ਕੇ ਇਸਦਾ ਰਿਜ਼ਲਟ ਇਹ ਹੈ ਕਿ ਸਾਨੂੰ ਰਵਾਇਤੀ ਸਲਾਹ ਸਾਡੇ ਬਜ਼ੁਰਗਾਂ ਪਾਸੋਂ ਬਹੁਤ ਜ਼ਿਆਦਾ ਮਿਲੀ ਹੈ